ਮੈਂ ਦਿਕਸ਼ਾ ਜ਼ਿਲ੍ਹਾ ਗੁਰਦਾਸਪੁਰ ਦੀ ਰਹਿਣ ਵਾਲੀ ਹਾਂ ਅਤੇ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਬੱਚਿਆਂ 'ਤੇ ਟੈਕਨੋਲੋਜੀ ਦੇ ਕੀ ਨੁਕਸਾਨ ਹਨ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅੱਜ ਦੇ ਸਮੇਂ ਵਿੱਚ ਬੱਚੇ ਮੋਬਾਈਲ ਫੋਨ ਟੀ ਵੀ ਇੰਟਰਨੈਟ ਜਾਂ ਫਿਰ ਕੰਪਿਊਟਰ ਦੀ ਬਹੁਤ ਜ਼ਿਆਦਾ ਵਰਤੋਂ ਕਰਦੇ ਹਨ ਜਿਸ ਨਾਲ ਉਹ ਟੀ ਵੀ ਮੋਬਾਇਲ ਜਾਂ ਕੰਪਿਊਟਰ ਦੀ ਸਕ੍ਰੀਨ ਨੂੰ ਬਿਨਾਂ ਅੱਖਾਂ ਝਪਕੇ ਬਹੁਤ ਸਮੇਂ ਤੱਕ ਦੇਖਦੇ ਰਹਿੰਦੇ ਹਨ ਅਤੇ ਇਸ ਨਾਲ ਉਹਨੇ ਉਹਨਾਂ ਦੀ ਅੱਖਾਂ ਉੱਤੇ ਅਸਰ ਪੈਂਦਾ ਹੈ ਅਤੇ ਜਿਸ ਨਾਲ ਉਹਨਾਂ ਦੀ ਅੱਖਾਂ 'ਤੇ ਰੋਸ਼ਨੀ 'ਤੇ ਵੀ ਫ਼ਰਕ ਪੈਂਦਾ ਹੈ ਅੱਖਾਂ ਖਰਾਬ ਹੋਣ ਲੱਗ ਪੈਂਦੀਆਂ ਹਨ ਅਤੇ ਉਸ ਤੋਂ ਇਲਾਵਾ ਕਿੰਨੇ ਕਿੰਨੇ ਦੇਰ ਤੱਕ ਇੱਕੋ ਜਗ੍ਹਾ ਬੈਠੇ ਰਹਿੰਦੇ ਹਨ ਜਿਸ ਕਰਕੇ ਉਹਨਾਂ ਦੀ ਫਿਜੀਕਲ ਐਕਟੀਵਿਟੀ ਘੱਟ ਹੁੰਦੀ ਹੈ ਜੋ ਕਿ ਬੱਚਿਆਂ ਲਈ ਬਹੁਤ ਹੀ ਜ਼ਿਆਦਾ ਨੁਕਸਾਨਦੇਹ ਹੁੰਦੀਆਂ ਹਨ ਅਤੇ ਕੁਝ ਬੱਚੇ ਗੇਮਸ ਖੇਡਦੇ ਹੋਏ ਹੈਡਫੋਨ ਦੀ ਵਰਤੋਂ ਵੀ ਕਰਦੇ ਹਨ ਜੋ ਕਿ ਉਹਨਾਂ ਦੇ ਕੰਨਾਂ ਲਈ ਬਹੁਤ ਹੀ ਹਾਨੀਕਾਰਕ ਹਨ ਇਸ ਨਾਲ ਉਹਨਾਂ ਦੀ ਸੁਣਨ ਦੀ ਸ਼ਮਤਾ ਘੱਟ ਹੋ ਸਕਦੀ ਹੈ ਪਰ ਬੱਚੇ ਇਹ ਟੈਕਨੋਲੋਜੀ ਦਾ ਇਸਤੇਮਾਲ ਆਪਣੇ ਜੀਵਨ ਵਿੱਚ ਰੈਗੂਲਰ ਕਰ ਰਹੇ ਹਨ ਅਤੇ ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਨੂੰ ਬੱਚਿਆਂ ਦੇ ਦੇਖਭਾਲ ਕਿਵੇਂ ਕਰਨੀ ਚਾਹੀਦੀ ਹੈ ਕਿ ਉਹ ਟੈਕਨੋਲਜੀ ਨਾਲ ਜ਼ਿਆਦਾ ਨੁਕਸਾਨ ਨਾ ਹੋ ਸਕਣ ਉਹਨਾਂ ਦੇ ਲਾਈਫ ਵਿੱਚ ਅਤੇ ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਬੱਚਾ ਕਿੰਨੀ ਦੇਰ ਫੋਨ ਚਲਾ ਰਿਹਾ ਹੈ ਅਤੇ ਕੀ ਕਰ ਰਿਹਾ ਹੈ ਬੱਚੇ ਨੂੰ ਫਿਜੀਕਲ ਐਕਟੀਵਿਟੀਜ ਕਰਵਾਉਂਦੇ ਰਹਿਣਾ ਚਾਹੀਦਾ ਹੈ ਉਸ ਨੂੰ ਆਊਟਡੋ ਆਊਟਡੋਰ ਗੇਮਸ ਵੀ ਕਰਵਾਉਣੀਆਂ ਚਾਹੀਦੀਆਂ ਹਨ ਧੰਨਵਾਦ